ਮੈਂ ਬਚਪਨ ਤੋਂ ਹੀ ਬੋਕਸਿੰਗ ਦਾ ਸ਼ੌਕੀਨ ਰਿਹਾ ਹਾਂ ਕਿਉਂਕਿ ਮੇਰੇ ਪਿਤਾ ਜੀ ਇੱਕ ਉੱਚ ਦਰਜੇ ਦੇ ਬੋਕਸਰ ਰਹਿ ਚੁੱਕੇ ਹਨ ਉਹਨਾਂ ਨੂੰ ਹੀ ਦੇਖ ਕੇ ਮੈਂ ਮੇਰਾ ਬੋਕਸਿੰਗ ਵੱਲ ਰੁਝਾਨ ਵਧਿਆ ਅਤੇ ਮੈਂ ਕਰਨੀ ਚਾਹੀ ਮੈਂ ਸਕੂਲ ਸਮੇਂ ਦੇ ਵਿੱਚ ਹੀ ਬੋਕਸਿੰਗ ਸਟਾਰਟ ਕਰ ਲਈ ਅਤੇ ਜੋਨ ਲੈਵਲ ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ਖੇਡਦਾ ਸੀ ਬਚਪਨ ਵਿੱਚ ਹੀ ਜਦੋਂ ਮੇਰੇ ਪਿਤਾ ਜੀ ਬੋਕਸਿੰਗ ਕਰਦੇ ਸਨ ਤਾਂ ਮੈਂ ਉਹਨਾਂ ਤੋਂ ਹੀ ਇਹੀ ਚੀਜ਼ਾਂ ਸਭ ਸਿੱਖੀਆਂ ਪ੍ਰੈਕਟਿਸ ਐਂਡ ਓਲ